ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਕੌਰ ਬੋਲ ਰਹੀਂ ਹਾਂ ਜੀ ਠੀਕ ਹੈ ਜੀ ਤੁਸੀਂ ਸੁਣਾਓ ਬਸ ਟਾਈਮ ਹੀ ਨਹੀਂ ਲੱਗਦਾ ਕੰਮ ਵਿੱਚ ਬੀਜ਼ੀ ਰਹਿੰਦੀ ਹਾਂ ਨਾ ਨਾ ਨਾ ਨਾ ਨਹੀਂ ਨਹੀਂ ਹੋਰ ਨਹੀਂ ਲੱਗਿਆ ਨਾ ਨਾ ਸੂਟ ਏ ਹੁਣ ਦੇਰ ਬਾਅਦ ਸਿਲਾ ਰਹੀਂ ਹਾਂ ਨਾ ਮੈਂ ਮੈਂ ਪੰਜਾਬੀ ਸੂਟ ਨਾ ਨਾ ਭੁੱਲੀ ਨਹੀਂ ਹੈਗੀ ਮੈਂ ਪੰਜਾਬੀ ਸੂਟ ਸਿਲਾਈ ਕਰਵਾਉਣਾ ਏ

ਨਹੀਂ ਨਹੀਂ ਟੇਲਰ ਨਹੀਂ ਚੇਂਜ ਕਰਿਆ ਮੈਂ ਸੂਟ ਏ ਨਹੀਂ ਸਵਾਇਆ ਕਾਫੀ ਟਾਈਮ ਤੋਂ ਹੁਣ ਪਹਿਲੇ ਪਏ ਸੀਗੇ ਨਾ ਇਸ ਕਰਕੇ ਲੋੜ ਨਹੀਂ ਪਈ ਅੱਛਾ ਅੱਛਾ ਅਤੇ ਫ਼ਿਰ ਨਾਪ ਵਗੈਰਾ ਥੋੜ੍ਹਾ ਜਿਹਾ ਚੇਂਜ ਹੋ ਗਿਆ ਮੈਂ ਤੁਹਾਨੂੰ ਨਾਪ ਦੱਸ ਦਿੰਦੀ ਹਾਂ ਤੁਸੀਂ ਲਿੱਖ ਲਿਓ ਲੈਂਥ ਹੈਗੀ ਥਰਟੀ ਏਟ ਟਵੰਟੀ ਕਮਰ ਪੰਦਰ੍ਹਾਂ ਅਠਾਰ੍ਹਾਂ ਵੀਹ ਕਿਤੇ ਕਿਤੇ 'ਤੇ ਵੱਧ ਗਿਆ ਕਿਤੇ 'ਤੇ ਨਾ ਕਿਤੇ 'ਤੇ ਵੱਧ ਗਿਆ ਕਿਤੇ 'ਤੇ ਘੱਟ ਗਿਆ ਨਹੀਂ ਯਾਰ ਜਿਵੇਂ ਦੇ ਮੈਂ ਪਹਿਲਾਂ ਪਾਉਂਦੀ ਹਾਂ ਠੀਕ ਠੀਕ ਜਿਹੇ ਰੱਖਿਓ ਸਾਢੇ ਛੇ ਕਰ ਦਿਓ ਚਾਰ ਬਹੁਤ ਆ ਬਾਂਹ ਕਰ ਦਿਓ ਪੋਣੇ ਪੰਦਰ੍ਹਾਂ ਇੰਚ ਲੰਬਾਈ ਕਰ ਦਿਓ ਤੁਸੀਂ

ਬਾਂਹ ਦੀ ਮੂਰੀ ਹੈਗੀ ਹੈ ਸਾਢੇ ਪੰਜ ਸਲਵਾਰ ਦੀ ਲੈਂਥ ਹੈ ਥਰਟੀ ਫੋਰ ਸਲਵਾਰ ਦਾ ਤਾਂ ਓਹੀ ਓ ਹੈ ਹਾਂਜੀ ਠੀਕ ਹੈ ਠੀਕ ਹੈ ਮੈਂ ਕੱਲ੍ਹ ਹੀ ਆਉਂਦੀ ਹਾਂ